ਕੁਝ ਸਭ ਤੋਂ ਆਮ ਗਲਤੀਆਂ ਹਨ ਜੋ ਸ਼ੁਰੂਆਤ ਕਰਨ ਵਾਲੇ ਬਾਈਕਰ ਕਰਦੇ ਹਨ ਪਹਿਲਾਂ ਤਾਂ ਉਹ ਬਾਇਕ ਚਲਾਉਣ ਸਮੇਂ ਹੈਲਮਟ ਨਹੀਂ ਲੈਂਦੇ ਉਸ ਤੋਂ ਬਾਅਦ ਸਟੈਂਡ ਚੁੱਕਣਾ ਭੁੱਲ ਜਾਂਦੇ ਹਨ ਅਤੇ ਰੋਡ 'ਤੇ ਲਾਲ ਬੱਤੀ ਦੀ ਉਲੰਘਣਾ ਕਰਦੇ ਹਨ ਅਤੇ ਸਪੀਡ ਲਿਮਿਟ ਤੋਂ ਜ਼ਿਆਦਾ ਰੱਖਦੇ ਹਨ ਕਈ ਵਾਰ ਥੋੜ੍ਹਾ ਜਿਹਾ ਨੇੜੇ ਜਾਣ ਵਾਸਤੇ ਰੋਂਗ ਸਾਈਡ ਚਲੇ ਜਾਂਦੇ ਹਨ ਅਤੇ ਇਹ ਸਾਰੀ ਗਲਤੀਆਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣੀ ਚਾਹੀਦੀ ਹੈ ਜਿਵੇਂ ਕਿ ਲਾਲ ਬੱਤੀ ਦੀ ਉਲੰਘਣਾ ਬਹੁਤ ਜ਼ਿਆਦਾ ਖ਼ਤਰਨਾਕ ਹੋ ਸਕਦੀ ਹੈ ਬਾਈਕਰ ਨੂੰ ਚਾਹੀਦਾ ਹੈ ਲਾਲ ਬੱਤੀ 'ਤੇ ਹਮੇਸ਼ਾ ਰੁਕੇ ਅਤੇ ਰੋਂਗ ਸਾਈਡ ਬਿਲਕੁਲ ਨਾ ਜਾਏ ਇੰਡੀਕੇਟਰ ਯੂਜ ਕਰੇ ਲੈਫਟ ਰਾਈਟ ਇੰਡੀਕੇਟਰ ਜੇ ਲੈਫਟ ਮੁੜਣਾ ਲੈਫਟ ਰਾਈਟ ਮੁੜਣਾ ਰਾਈਟ ਅਤੇ ਗਰੀਨ ਬੱਤੀ 'ਤੇ ਹਮੇਸ਼ਾ ਚੱਲੇ ਅਤੇ ਬਾਈਕਰ ਨੂੰ ਚਾਹੀਦਾ ਹੈ ਕਿ ਲਿਮਿਟ ਸਪੀਡ ਦੀ ਲਿਮਿਟ ਰੱਖੇ ਸਪੀਡ ਨਾਲ ਚਲਾਉਣਾ ਖ਼ਤਰਾ ਹੋ ਸਕਦਾ ਹੈ ਅਤੇ ਅਗਰ ਬਾਈਕ 'ਤੇ ਦੋ ਬੰਦੇ ਸਵਾਰ ਹਨ ਤਾਂ ਦੋਨਾਂ ਨੂੰ ਹੈਲਮਟ ਲੈਣਾ ਜ਼ਰੂਰੀ ਹੈ ਅਤੇ ਬਾਈਕ ਚਲਾਉਂਦੇ ਸਮੇਂ ਕੋਈ ਵੀ ਅਣਗਹਿਲੀ ਨਹੀਂ ਕਰਨੀ ਚਾਹੀਦੀ ਮੋਬਾਇਲ ਯੂਜ ਕਰਦੇ ਹਨ ਹੈਡਫੋਨ ਲਾ ਕੇ ਚਲਾਉਂਦੇ ਹਨ ਇਹ ਸਭ ਬਹੁਤ ਜ਼ਿਆਦਾ ਖ਼ਤਰਨਾਕ ਹੈ ਚਲਦੀ ਬਾਈਕ 'ਤੇ ਮੋਬਾਈਲ ਯੂਜ ਕਰਨਾ ਧਿਆਨ ਸਾਰਾ ਮੋਬਾਈਲ ਵੱਲ ਚਲਾ ਜਾਂਦਾ ਹੈ ਅਤੇ ਦੁਰਘਟਨਾ ਦਾ ਕਾਰਨ ਬਣ ਜਾਂਦਾ ਹੈ ਮੋਬਾਈਲ ਇਸ ਕਰਕੇ ਆਪਣੇ ਆਪ ਨੂੰ ਸੇਫ ਰੱਖਣ ਵਾਸਤੇ ਜਿੰਨੇ ਵੀ ਕਾਨੂੰਨੀ ਰੂਲ ਹਨ ਉਹਨਾਂ ਦੇ ਮੁਤਾਬਿਕ ਚੱਲਣਾ ਚਾਹੀਦਾ ਚਾਹੀਦਾ ਹੈ ਅਤੇ ਪੂਰੇ ਧਿਆਨ ਨਾਲ ਬਾਇਕ ਚਲਾਉਣੀ ਚਾਹੀਦੀ ਹੈ ਰੋਂਗ ਸਾਈਡ ਨਹੀਂ ਜਾਣਾ ਚਾਹੀਦਾ ਅਤੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ